ਜਿਹੜਾ ਅੱਜ ਦਾ ਟਾਈਮ ਹੈ ਉਹ ਜ਼ਿਆਦਾਤਰ ਹੈਗਾ ਟਾਈਮ ਡਿਜੀਟਲ ਆ ਡਿਜੀਟਲ ਜ਼ਿਆਦਾ ਮਤਲਬ ਕਰ ਰਿਹਾ ਹੈ ਨਾ ਇਹਦੇ 'ਚ ਕੀ ਹੈ ਮਤਲਬ ਮੈਂ ਪੰਜਾਬ 'ਚ ਜਿੱਦਾਂ ਹੁਣ ਮੰਨ ਲਓ ਕਰੋਨਾ ਕਾਲ ਆਇਆ ਸੀਗਾ ਨਾ ਕਰੋਨਾ ਕਾਲ 'ਚ ਕੀ ਹੈ ਮਤਲਬ ਲੋਕ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ ਸੀ ਹੈ ਨਾ ਕੋਈ ਜੋਬ ਕਰਦਾ ਸੀ ਤਾਂ ਵਰਕ ਫਰੋਮ ਹੋਮ ਕਰਨ ਲੱਗ ਗਿਆ ਉਹ ਹੈ ਨਾ ਜਾਂ ਸਟਡੀ ਕਰਦੇ ਸੀ ਜਿੱਦਾਂ ਸਟੂਡੈਂਟ ਕੋਈ ਹੈਗੇ ਆ ਹੈ ਨਾ ਉਹ ਮਤਲਬ ਉਹਨਾਂ ਦੀਆਂ ਆਨਲਾਈਨ ਕਲਾਸੀਜ ਲੱਗਣ ਲੱਗ ਗਈਆਂ ਹੈ ਨਾ ਇਹਦੇ ਵਿੱਚ ਕੀ ਹੈ ਮਤਲਬ ਕਿ ਹੈ ਬੰਦੇ ਨੂੰ ਜਾਂ ਅਗਾਂਹ ਦੀ ਅਗਾਂਹ ਉਦੋਂ ਸਿਸਟਮ ਜਿਹੜਾ ਵੱਧਦਾ ਗਿਆ ਹੈ ਨਾ ਇਸ ਤੋਂ ਬਾਅਦ ਮਤਲਬ ਮੈਂ ਇਹ ਚੀਜ਼ ਚਾਹੁੰਦਾ ਹਾਂ ਜਿਹੜਾ ਇਹ ਸਿਸਟਮ ਹੈ ਜਿਹੜਾ ਆਨਲਾਈਨ ਵਾਲਾ ਸਿਸਟਮ ਹੈ ਨਾ ਇਹਨੂੰ ਜ਼ਿਆਦਾ ਬੰਦੇ ਨੂੰ ਪ੍ਰੈਫਰ ਕਰਨਾ ਚਾਹੀਦਾ ਆ ਕਿਉਂਕਿ ਕਿਸੇ ਵੀ ਤਰ੍ਹਾ ਦੀ ਕਿਸੇ ਵੀ ਤਰ੍ਹਾਂ ਦੀ ਮਤਲਬ ਕੋਈ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਤਾਂ ਜਿਹੜਾ ਉਹ ਹੈ ਜ਼ਿਆਦਾਤਰ ਪਹਿਲਾਂ ਹੀ ਮਤਲਬ ਬੈਂਗਲੋਰ ਵਗੈਰਾ ਨੋਇਡਾ ਵਗੈਰਾ 'ਚ ਜ਼ਿਆਦਾ ਸਿਸਟਮ ਹੈਗਾ ਹੈ ਨਾ ਇਹਦਾ ਮੈਂ ਚਾਹੁੰਦਾ ਕਿ ਜਿਹੜਾ ਪੰਜਾਬ ਵਿੱਚ ਬੜੇ ਵੱਡੇ ਪੱਧਰ 'ਤੇ ਹੋਣੇ ਚਾਹੀਦੇ ਆ ਕਿਉਂਕਿ ਜੇ ਔਨਲਾਈਨ ਸਿਸਟਮ ਹੋਊਗਾ ਹੈ ਨਾ ਜਾਂ ਕੋਈ ਵੀ ਚੀਜ਼ ਹੈਗੀ ਆ ਹੈ ਨਾ ਅਤੇ ਮੰਨ ਲਓ ਹੁਣ ਮੈਂ ਗੇਮ ਵਗੈਰਾ ਖੇਡਦਾ ਹੈ ਨਾ ਔਨਲਾਈਨ ਗੇਮਾਂ ਖੇਡਦਾ ਜਾਂ ਕੁਛ ਵੀ ਹੈ ਨਾ ਇਹਦੇ ਨਾਲ ਕੀ ਹੈ ਬੱਚੇ ਦਾ ਮਨੋਰੰਜਨ ਕੋਈ ਬੱਚਾ ਚਾਹੇ ਕੋਈ ਵੀ ਆ ਬੱਚਾ ਹੈ ਨਾ ਉਹਦਾ ਜਿਹੜਾ ਉਹ ਹੈ ਉਹ ਵੱਧਦਾ ਰਹਿੰਦਾ ਜਿਹੜਾ ਹੌਂਸਲਾ ਵੱਧਦਾ ਜਾਂ ਆਮ ਬੰਦੇ ਦੇ ਆਪਸ 'ਚ ਵੀ ਉਹ ਹੁੰਦਾ ਰਹਿੰਦਾ ਸਿਸਟਮ ਤਾਂ ਜੇ ਆਪਾਂ ਕੋਈ ਇਹ ਕਰਾਂਗੇ ਉਹਦੇ ਵਿੱਚ ਤਬਦੀਲੀਆਂ ਆਉਣਗੀਆਂ ਆਉਣਗੀਆਂ ਨੈਚਰਲੀ ਗੱਲ ਹੈ ਤਬਦੀਲੀਆਂ ਆਉਂਣਗੀਆਂ ਤਾਂ ਫਿਰ ਕਿਤੇ ਨਾ ਕਿਤੇ ਜਾ ਕੇ ਉਹਦਾ ਫ਼ਾਇਦਾ ਹੋਵੇਗਾ ਹੀ ਇਸ ਚੀਜ਼ ਦਾ ਹੈ ਨਾ ਠੀਕ ਹੈ ਜੀ